ਕੋਲਜਾਂ ਦੇ ਵਿੱਚ ਅਸੀਂ ਅਕਸਰ ਅਬਦੁਲ ਕਲਾਮ ਬਾਰੇ ਸੁਣਦੇ ਰਹੇ ਹਾਂ ਜਿਹੜੇ ਸਾਡੇ ਦੇਸ਼ ਦੇ ਰਾਸ਼ਟਰਪਤੀ ਤਾਂ ਰਹੇ ਹੀ ਹਨ ਪਰ ਉਹ ਸਾਡੇ ਦੇਸ਼ ਦੇ ਬੜੇ ਵੱਡੇ ਵਿਗਿਆਨੀ ਵੀ ਸਨ ਉਹਨਾਂ ਨੂੰ ਮਿਜ਼ਾਇਲ ਮੈਨ ਕਹਿੰਦੇ ਸੀ ਔਰ ਅਸੀਂ ਉਹਨਾਂ ਕੋਲੋਂ ਬੜਾ ਕੁਝ ਸਿੱਖਿਆ ਕਿ ਕਿਵੇਂ ਜੀਵਨ ਦੇ ਵਿੱਚ ਵਿਚਰਨਾ ਅਤੇ ਉਹ ਇੱਕ ਸਾਇੰਸਦਾਨ ਹੋਣ ਦੇ ਨਾਲ਼ ਨਾਲ਼ ਅੱਛੇ ਰਾਜਨੀਤਿਕ ਵਿਅਕਤੀ ਵੀ ਹੋਏ ਆ ਔਰ ਉਨ੍ਹਾਂ ਨੇ ਬਕਾਇਦਾ ਪ੍ਰੈਕਟੀਕਲੀ ਕੰਮ ਕਰਕੇ ਲੋਕਾਂ ਨੂੰ ਦੱਸਿਆ ਕਿ ਕਿਵੇਂ ਵਿਚਰਨਾ ਹੈ